ਮੈਂ ਗੌਰਮਿੰਟ ਕਾਲਜ ਰੋਪੜ ਤੋਂ ਗੱਲ ਕਰ ਰਿਹਾਂ ਹਾਂ ਅਤੇ ਮੈਂ ਚੰਡੀਗੜ੍ਹ ਜਾਣਾ ਚਾਹੁੰਦਾ ਹਾਂ ਇਸ ਲਈ ਮੈਨੂੰ ਦੱਸਿਆ ਜਾਵੇ ਕਿ ਉਰੇ ਚੰਡੀਗੜ੍ਹ ਜਾਣ ਲਈ ਕਿਹੜੇ ਕਿਹੜੇ ਵਾਹਨ ਉਪਲਬਧ ਹਨ